ਹੈਲੋ ਹਾਂਜੀ ਐਮਾਜ਼ੋਨ ਤੋਂ ਬੋਲਣ ਡੇਆਂ ਜੇ ਹਾਂਜੀ ਸਰ ਮੈਂ ਨਾ ਤੁਹਾਡੇ ਐਮਜ਼ੋਨ ਤੋਂ ਦੋ ਚੀਜ਼ਾਂ ਮੰਗਾਈਆਂ ਸੀ ਇੱਕ ਜੀਨ ਦੀ ਪੈਂਟ ਮੰਗਾਈ ਜੀਨ ਮੰਗਾਈ ਸੀ ਉਹ ਤਾਂ ਬਹੁਤ ਵਧੀਆ ਨਿਕਲੀ ਦੂਸਰਾ ਮੈਂ ਪ੍ਰੋਡਕਟ ਮੰਗਾਇਆ ਸੀ ਤੁਹਾਡੇ ਕੋਲੋਂ ਮਿੰਨੀ ਸਪੀਕਰ ਮਿੰਨੀ ਸਪੀਕਰ ਜਿਹੜਾ ਸੀ ਉਹਦੇ ਬਾਰੇ ਤੁਹਾਨੂੰ ਮੈਂ ਸ਼ਿਕਾਇਤ ਕਰਨੀ ਸੀ ਵੀ ਉਹ ਜਿਹੜਾ ਮੈਂ ਤੁਹਾਡੀ ਸਾਈਟ 'ਤੇ ਵੇਖਿਆ ਸੀ ਉਹ ਹੋਰ ਅਲੱਗ ਚੀਜ਼ ਸੀ ਅਤੇ ਵੱਖਰੀ ਚੀਜ਼ ਸੀ ਅਤੇ ਜਿਹੜਾ ਤੁਸੀਂ ਮੈਨੂੰ ਭੇਜ ਦਿੱਤਾ ਵਾ ਉਹ ਹੋਰ ਵੱਖਰੀ ਚੀਜ਼ ਆ ਕਿਉਂਕਿ ਉਹ ਤਾਂ ਬਿਲਕੁਲ ਉਹਦੇ ਨਾਲ਼ੋਂ ਡਿਫਰੈਂਟ ਹੈਗਾ ਵਾ ਕੋਈ ਉਹਦੇ ਵਿੱਚ ਹੈਗੀ ਨਹੀਂ ਆ ਮਤਲਬ ਗੱਲ ਕੁਆਲਿਟੀ ਉਹ ਜਿਹੜੀ ਮੈਨੂੰ ਚਾਹੀਦੀ ਸੀ ਉਹ ਕੁਆਲਿਟੀ ਹੈ ਹੀ ਨਹੀਂ ਆ ਤੁਸੀਂ ਉਹਦੀਆਂ ਬਹੁਤ ਤਾਰੀਫ਼ਾਂ ਕੀਤੀਆਂ ਉਹਦੇ ਤਾਂ ਰਿਵਿਊ ਵੀ ਬਹੁਤ ਚੰਗੇ ਸੀ ਪਰ ਉਹਦੇ ਵਿੱਚ ਉਹ ਚੀਜ਼ਾਂ ਨਹੀਂ ਨਿਕਲੀਆਂ ਨਾ ਤਾਂ ਉਹਦੀ ਚੰਗੀ ਤਰ੍ਹਾਂ ਬੈਂਟਰੀ ਬੈਕਅੱਪ ਦੇ ਰਹੀ ਆ ਅਤੇ ਬੈਟਰੀ ਬੈਕਅੱਪ ਨਹੀਂ ਦੇ ਰਹੀ ਉਹਦੀ ਸਾਊਂਡ ਦੀ ਜਿਹੜੀ ਕੁਆਲਿਟੀ ਆ ਉਹ ਵੀ ਬਿਲਕੁਲ ਡਿਫਰੈਂਟ ਆ ਉਹ ਆਮ ਨਾਲ਼ੋਂ ਅਤੇ ਇੱਕ ਉਹਦਾ ਬਲੂਟੁੱਥ ਚੰਗੀ ਤਰ੍ਹਾਂ ਵਰਕ ਨਹੀਂ ਕਰ ਰਿਹਾ ਅਤੇ ਹੁਣ ਤੁਸੀਂ ਮੈਨੂੰ ਇਹਦੇ ਬਾਰੇ ਵੀ ਤੁਸੀਂ ਮੈਨੂੰ ਚੇਂਜ ਕਰਕੇ ਦੇ ਸਕਦੇ ਜੇ ਅਤੇ ਇਹਦੇ ਬਾਰੇ ਤੁਸੀਂ ਮੈਨੂੰ ਕਿੰਨੀ ਛੇਤੀ ਦੱਸ ਸਕਦੇ ਜੇ